ਆਪਾਂ ਨੂੰ ਯੋਗਾ ਨਿੱਤ ਰੋਜ਼ ਸਵੇਰੇ ਰੁਟੀਨ ਨਾਲ ਕਰਨਾ ਚਾਹੀਦਾ ਯੋਗੇ ਦੇ ਯੋਗਾ ਦੇ ਫਾਇਦੇ ਮੈਨੂੰ ਬਹੁਤ ਗੋਡਿਆਂ ਵਿੱਚ ਮੋਢਿਆਂ ਵਿੱਚ ਦਰਦ ਬਹੁਤ ਹੁੰਦਾ ਸੀ ਇਸ ਕਰਕੇ ਮੈਂ ਯੋਗਾ ਕਰਦੀ ਸੀ ਮੇਰੇ ਗੋਡੇ ਮੋਢਿਆਂ ਦਾ ਦਰਦ ਬਿਲਕੁਲ ਠੀਕ ਹੈ ਮੈਨੂੰ ਸਾਹ ਵ ਲੈਣ ਵਿੱਚ ਵੀ ਬਹੁਤ ਸਹੀ ਰਹਿੰਦਾ ਹੈ ਇਸ ਕਰਕੇ ਮੈਂ ਯੋਗਾ ਆਪ ਵੀ ਰੁਟੀਨ ਵਿੱਚ ਕਰਦੀ ਹਾਂ ਤਾਂ ਦੂਸਰਿਆਂ ਨੂੰ ਵੀ ਕਰਨ ਲਈ ਕਹਿੰਦੀ ਹਾਂ ਮੈਂ ਸਹੇਲੀਆਂ ਨਾਲ ਜਾ ਕੇ ਪਾਰਕ ਵਿੱਚ ਯੋਗਾ ਆਪ ਵੀ ਕਰਦੀ ਹਾਂ ਅਤੇ ਉਹਨਾਂ ਨੂੰ ਸਿਖਾਉਣੀ ਹਾਂ ਮੇਰੇ ਵਿੱਚ ਖੂਨ ਦੀ ਵੀ ਬਹੁਤ ਘਾਟ ਸੀ ਇਸ ਕਰਕੇ ਮੈਂ ਖੂਨ ਮੇਰਾ ਖੂਨ ਵੀ ਬਹੁਤ ਪੂਰਾ ਹੈ ਅਤੇ ਤੰਦਰੁਸਤ ਵੀ ਪੂ ਹੈ ਇਸ ਕਰਕੇ ਮੈਨੂੰ ਯੋਗਾ ਬਹੁਤ ਚੰਗਾ ਲੱਗਦਾ ਸਭ ਨੂੰ ਆਪਾਂ ਨੂੰ ਯੋਗਾ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਇਹੀ ਰਾਏ ਦਿੰਦੀ ਹਾਂ ਵੀ ਆਪਾਂ ਯੋਗਾ ਸਵੇਰੇ ਉੱਠ ਕੇ ਰੋਜ਼ ਸਵੇਰੇ ਕਰੋ ਯੋਗਾ ਕਰੋ ਸਾਰੇ ਮੇਰੀਆਂ ਸਹੇਲੀਆਂ ਸਾਰੇ ਭੈਣ ਭਾਈ ਗਲੀ ਗਵਾਂਢ ਸਭ ਯੋਗਾ ਕਰਦੇ ਹਨ ਇਸ ਕਰਕੇ ਉਹ ਸਾਰੇ ਤੰਦਰੁਸਤ ਹਨ ਸਭ ਦੇ ਖੂਨ ਵਿੱਚ ਕਿਸੇ ਦੀ ਖੂਨ ਵਿੱਚ ਕਮੀ ਸੀ ਤਾਂ ਸਭ ਦਾ ਖੂਨ ਪੂਰਾ ਹੈ ਇਸ ਟਾਈਮ ਮੇਰਾ ਖੂਨ ਵੀ ਬਹੁਤ ਸਹੀ ਹੈ ਮੇਰੇ ਸਾਹ ਵਿੱਚ ਬਹੁਤ ਤਕਲੀਫ ਸੀ ਹੁਣ ਮੈਂ ਯੋਗਾ ਕਰਨ ਨਾਲ ਮੇਰਾ ਸਿਰ ਦਰਦ ਵੀ ਠੀਕ ਹੈ ਮੇਰੀ ਮੇਰੀ ਧੌਣ ਦੀ ਨਾੜ ਬਹੁਤ ਦੁਖਦੀ ਹੁੰਦੀ ਸੀ ਯੋਗਾ ਕਰਨ ਨਾਲ ਮੇਰੀ ਧੌਣ ਵੀ ਸਹੀ ਹੈ ਮੇਰੇ ਗੋਡੇ ਮੋਢਿਆਂ ਦਾ ਦਰਦ ਸਭ ਸਹੀ ਹੈ ਇਸ ਕਰਕੇ ਮੈਂ ਯੋਗਾ ਆਪ ਵੀ ਕਰਦੀ ਹਾਂ ਅਤੇ ਮੈਂ ਸਹੇਲੀਆਂ ਨੂੰ ਵੀ ਰੋਜ਼ ਕਹਿਦੀ ਹਾਂ ਵੀ ਭਾਈ ਯੋਗਾ ਕਰੋ ਸਭ ਯੋਗਾ ਕਰਦੇ ਹਨ ਯੋਗਾ ਦੇ ਬਹੁਤ ਲਾਭ ਹਨ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ ਯੋਗਾ ਸਵੇਰ ਵੇਲੇ ਉੱਠ ਕੇ ਨਿਰਣੇ ਕਾਲਜੇ ਯੋਗਾ ਕਰਨਾ ਚਾਹੀਦਾ ਹੈ ਇਸ ਕਰਕੇ ਆਪਾਂ ਨੂੰ ਯੋਗੇ ਦੇ ਬਹੁਤ ਲਾਭ ਹਨ